ਗੁਰਦੀਪ ਸਿੰਘ ਬੋਲ ਰਹੇ ਮੈਂ ਸਰੋਜ ਬੋਲਦੀ ਸੀ ਮੇਰੇ ਦੋ ਬੇਟੇ ਹੈ ਜੀ ਇੱਕ ਸੱਤ ਸਾਲ ਦਾ ਇੱਕ ਦਸ ਸਾਲ ਦਾ ਅਤੇ ਉਹ ਬਰਨਾਲੇ ਪਤਾ ਕਰਨਾ ਸੀਗਾ ਜੀ ਉਹਨਾਂ ਨੇ ਐਡਮਿਸ਼ਨ ਕਰਵਾਉਣੀ ਸੀ ਵੀ ਇੱਥੇ ਕੀ ਖੇਡਾਂ ਨੇ ਕੀ ਹੋਰ ਨੇ ਅੱਛਾ ਜੀ ਠੀਕ ਹੈ ਜੀ ਹਾਂਜੀ ਓਕੇ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਫੀਸ ਕਿੰਨੀ ਆ ਸਰ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਸਰ ਔਨਲਾਈਨ ਬੁੱਕ ਕਰਨ ਵੇਲੇ ਕੋਈ ਮਤਲਬ ਦਿੱਕਤ ਆਈ ਫਿਰ ਤੁਹਾਨੂੰ ਇਸ ਨੰਬਰ 'ਤੇ ਫੋਨ ਕਰੀਏ